ਇੱਥੇ ਕਈ ਛੁਪੇ ਹੋਏ ਰਤਨ ਜਾਂ ਔਫ ਦਾ ਬੀਟ ਪਾਥ ਟਿਕਾਣੇ ਹਨ ਜਿਨ੍ਹਾਂ ਬਾਰੇ ਸੈਲਾਨੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਪਰ ਸਾਡੇ ਸੈਲਾਨੀਆਂ ਨੂੰ ਨਹੀਂ ਪਤਾ ਹੈ ਤਾਂ ਮੈਂ ਅਪੀਲ ਕਰਨਾ ਚਾਹਵਾਂਗੀ ਕਿ ਜਿਨ੍ਹਾਂ ਨੂੰ ਵੀ ਇਹ ਛੁਪੇ ਹੋਏ ਰਤਨਾਂ ਬਾਰੇ ਪਤਾ ਹੈ ਉਹ ਸੈਲਾਨੀਆਂ ਨੂੰ ਦੱਸ ਕੇ ਦੇਸ਼ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਇਹਨਾਂ ਜਗ੍ਹਾਵਾਂ ਬਾਰੇ ਜਾਨਣ 'ਚ ਵੀ ਮਦਦ ਕਰਨ ਅਤੇ ਹੋਰ ਵੀ ਕਾਫੀ ਵਿਕਾਸ ਹੋ ਸਕਦਾ ਹੈ ਜੇਕਰ ਆਪਾਂ ਇਹਨਾਂ ਚੀਜ਼ਾਂ ਬਾਰੇ ਉਨ੍ਹਾਂ ਲੋਕਾਂ ਨੂੰ ਦੱਸੀਏ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਕੋਈ ਵੀ ਖਿਆਲ ਨਹੀਂ ਹੈ ਔਫ ਦਾ ਬੀਟ ਅਤੇ ਛੁਪੇ ਹੋਏ ਰਤਨ ਜਿਨ੍ਹਾਂ ਬਾਰੇ ਸਾਡੇ ਸੈਲਾਨੀਆਂ ਨੂੰ ਨਹੀਂ ਪਤਾ ਇਹ ਸਾਡਾ ਫਰਜ਼ ਬਣਦਾ ਹੈ ਕਿ ਜਿਨ੍ਹਾਂ ਨਾਗਰਿਕਾਂ ਨੂੰ ਇਹਨਾਂ ਬਾਰੇ ਪਤਾ ਹੈ ਜਾਂ ਸੈਲਾਨੀਆਂ ਨੂੰ ਉਹਨਾਂ ਉਹਨਾਂ ਬਾਰੇ ਪਤਾ ਹੈ ਉਹ ਬਾਕੀ ਸੈਲਾਨੀਆਂ ਨੂੰ ਦੱਸਣ ਦਾ ਵੀ ਕਸ਼ਟ ਕਰਨ ਅਤੇ ਆਪਣਾ ਫਰਜ਼ ਨਿਭਾਉਣ ਅਤੇ ਕਿਉਂਕਿ ਇਹ ਛੁਪੇ ਹੋਏ ਰਤਨ ਛੁਪੇ ਹੋਏ ਰਤਨ ਜਾਂ ਬਾਕੀ ਚੀਜ਼ਾਂ 'ਤੇ ਵੀ ਚੀਜ਼ਾਂ 'ਤੇ ਵੀ ਆਪਣਾ ਦ੍ਰਿਸ਼ ਜਾਰੀ ਕਰਨ ਅਤੇ ਆਪਣੇ ਹਰੇਕ ਬਾਰੇ ਦੱਸਿਆ ਜਾਏ ਅਤੇ ਵਿਚਾਰ ਸਾਂਝੇ ਕੀਤੇ ਜਾਣ